ਹੈਲੋ ਹੋਰ ਬਾਬੇ ਕਿਵੇਂ ਹਾਂ ਹੋਰ ਕਿੰਨੇ ਨੰਬਰ ਆਏ ਬਾਰ੍ਹਵੀਂ 'ਚੋਂ ਆ ਗਏ ਹੋਰ ਅੱਗੇ ਕੀ ਕਰਨਾ ਫਿਰ ਮੈਂ ਵੀ ਚੰਡੀਗੜ੍ਹ ਲੱਗ ਜਾਈਏ

ਹੋਰ ਤਾਂ ਆਪਾਂ ਰੱਖ ਲਵਾਂਗੇ ਬੀ ਕਾਮ ਰੱਖ ਲਵਾਂਗੇ ਉੱਥੀ ਹੋ ਹਾਂ ਬੀ ਕਾਮ ਰੱਖ ਲਵਾਂਗੇ ਨਾਲੇ ਵਧੀਆ ਰਹਿ ਜਾਊਗਾ ਨਾਲੇ ਉੱਥੇ ਮੈਂ ਜਿੰਨੇ ਵੀ ਦੇਖੇ ਨੇ ਜਿਹੜੇ ਵਧੀਆ ਅਕਾਊਂਟੈਂਟ ਵਧੀਆ ਜੋਬ ਲੱਗੇ ਹੋਏ ਨੇ ਉੱਥੇ ਦੇ ਜਿਹੜੇ ਉੱਥੇ ਪੜ੍ਹੇ ਨੇ ਆਪਾਂ ਜਾ ਕੇ ਆਵਾਂਗੇ ਇੱਕ ਵਾਰ ਪਤਾ ਕਰਕੇ ਆਵਾਂਗੇ ਉੱਥੇ ਚੰਗੀ ਤਰ੍ਹਾਂ ਇੱਕ ਹੈ ਬੰਦਾ ਵੀ ਹੈ ਉੱਥੇ ਆਪਣਾ ਚੱਲ ਨਹੀਂ ਅਪ ਡਾਊਨ ਦਾ ਕਾਹਦਾ ਇੱਥੋਂ ਆਪਾਂ ਚੱਲਿਆ ਕਰਾਂਗੇ ਮੋਟਰਸਾਈਕਲ 'ਤੇ ਉੱਚੇ ਪਿੰਡ ਤੱਕ ਉੱਚੇ ਪਿੰਡ ਤੋਂ ਬੱਸ ਮਿਲ ਜਾਂਦੀ ਹੈ ਚੰਡੀਗੜ੍ਹ ਨੂੰ ਨਾਲੇ ਵਧੀਆ ਹਾਈਵੇ ਰੋਡ ਆ ਨਾ ਕਿਸੇ ਸਟੋਪ ਸਟੂਪ ਘੱਟੇ ਆਉਂਦੇ ਨੇ ਉੱਥੇ ਸਿੱਧਾ ਉਹਨੇ ਚੰਡੀਗੜ੍ਹ ਮਾਰਨਾ ਆਪਾਂ ਨੂੰ ਇੱਧਰ ਨਾਲੇ ਰਾਹ ਦੇ ਵਿੱਚ ਆ ਜਾਂਦਾ ਸੀ ਜੀ ਉਹ ਹੈ ਇੱਕ ਵਾਰ ਚੈੱਕ ਕਰ ਆਉਂਦੇ ਆਪਾਂ ਸਾਰੇ ਕਿਤੇ ਫਿਰ ਹੈ ਕਰ ਲੈਂਦੇ ਹਾਂ ਹਾਂ ਇੱਕ ਦੋ ਵਾਰ ਗੇੜਾ ਮਾਰਿਆ ਆਉਂਦੇ ਫਿਰ ਆਪਾਂ ਹੈ ਕਿ ਨਹੀਂ ਆ ਫਤਿਹਗੜ੍ਹ ਸਾਹਿਬ ਵੀ ਆ ਫਤਿਹਗੜ੍ਹ ਸਾਹਿਬ ਵੀ ਵਧੀਆ ਮਾਤਾ ਗੁਜਰੀ 'ਚ ਐਡਮਿਸ਼ਨ ਯਾਰ ਘੱਟ ਮਿਲਦੀ ਆ ਇੰਨੀ ਮਿਲਦੀ ਨਹੀਂ ਹੈਗੀ ਹਾਂ ਦੇਖ ਲੈਂਦੇ ਹਾਂ ਆਪਾਂ ਹੈ ਕੱਲ੍ਹ ਕੱਲ੍ਹ ਨੂੰ ਦੇਖੀਏ ਫਿਰ ਕੱਲ੍ਹ ਨੂੰ ਫੇਰ ਮੈਂ ਤੈਨੂੰ ਫੋਨ ਕਰੂੰਗਾ ਦਸ ਕੁ ਵਜੇ ਤਿਆਰ ਰਹੀ ਹਾਂ ਫਤਿਹਗੜ੍ਹ ਸਾਹਿਬ 'ਚ ਮਾਤਾ ਗੁਜਰੀ ਕੋਲਜ 'ਚ ਚੱਲਾਂਗੇ ਫਿਰ ਆਪਾਂ ਹਾਂ ਜੇ ਉੱਥੇ ਨਹੀਂ ਮਿਲੀ ਫਿਰ ਆਪਾਂ ਇੱਥੇ ਸੀ ਯੂ ਦੇਖ ਲਵਾਂਗੇ ਵਧੀਆ ਯੂਨੀਵਰਸਿਟੀ ਨਾਲੇ ਚੱਲ ਠੀਕ ਹਾਂ